ਮੇਰੀ ਭੂਆ ਜੀ ਨੇ ਉਹ ਦਿੱਲੀ ਤੋਂ ਨੇ ਅਤੇ ਉਹਨਾਂ ਨੇ ਨਾ ਮੈਨੂੰ ਚਾਣਕਿਆ ਨੀਤੀ ਕਿਤਾਬ ਬਹੁਤ ਫੋਰਸ ਕਰਦੇ ਸੀ ਵੀ ਪੜ੍ਹ ਕੇ ਦੇਖੋ ਉਹ 'ਚ ਜ਼ਿੰਦਗੀ ਬਾਰੇ ਬਹੁਤ ਕੁਛ ਲਿਖਿਆ ਹਰ ਚੀਜ਼ ਹਰ ਪਹਿਲੂ ਬਾਰੇ ਜ਼ਿੰਦਗੀ ਦੇ ਬਹੁਤ ਕੁਛ ਲਿਖਿਆ ਅਤੇ ਮੈਂ ਥੋੜ੍ਹੀ ਜਿਹੀ ਆਨਾ ਕਾਨੀ ਕਰਦਾ ਸੀ ਪੜ੍ਹਨ ਨੂੰ ਅਤੇ ਉਹਨਾਂ ਨੇ ਆਪ ਪੱਲੋਂ ਮੈਨੂੰ ਖ਼ਰੀਦ ਕੇ ਲਿਆ ਕੇ ਦਿੱਤੀ ਵੀ ਪੜ੍ਹੋ ਤੁਸੀਂ ਇਹਨੂੰ ਆਏ ਪੇ ਸੀ ਪਿੱਛੇ ਜਿਹੇ ਅਤੇ ਚਲੋ ਮੈਂ ਪੜ੍ਹੀ ਸ਼ਾਇਦ ਮੈਂ ਉਸ ਡੂੰਘਾਈ ਤੱਕ ਨਹੀਂ ਪੜ੍ਹੀ ਹੈ ਜਾਂ ਮੇਰਾ ਰੁਝਾਨ ਇੰਨਾ ਨਹੀਂ ਸੀਗਾ ਇਸ ਬਾਰੇ ਪੜ੍ਹਨ ਨੂੰ ਅਤੇ ਮੈਨੂੰ ਉਹ ਚੀਜ਼ ਸਮਝ ਨੀ ਲੱਗੀ ਵੀ ਜਿੰਨਾ ਉਹਨਾਂ ਨੇ ਤਾਰੀਫ ਕੀਤੀ ਸੀ ਇਸ ਚੀਜ਼ ਦੀ ਵੀ ਇਹ ਦੁਨੀਆ ਦੇ ਹਰ ਚੀਜ਼ ਬਾਰੇ ਹਰ ਢੰਗ ਬਾਰੇ ਨਾ ਲਿਖਿਆ ਅਤੇ ਮੈਂ ਪੜ੍ਹਿਆ ਪਰ ਮੈਨੂੰ ਇੰਨਾ ਸਿੱਖਣ ਨੂੰ ਕੁਛ ਸੀਗਾ ਨਹੀਂ ਮਿਲਿਆ ਵੀ ਜੋ ਆਮ ਚੀਜ਼ਾਂ ਨਾ ਬਾਹਰੋਂ ਸਿੱਖੀਆਂ ਨੇ ਉਹ ਚੀਜ਼ਾਂ ਸੀਗੀਆਂ ਅਤੇ ਮੈਂ ਸ਼ਾਇਦ ਮੇਰਾ ਹੀ ਰੁਝਾਨ ਨਹੀਂ ਸੀਗਾ ਉਸ 'ਚ ਤਾਂ ਕਰਕੇ ਪਤਾ ਨਹੀਂ ਤਾ ਹੀ ਸੀਗਾ ਵੀ ਇੰਨਾ ਰੁਝਾਨ ਨਾ ਕਰਕੇ ਹੋਣ ਕਰਕੇ ਹੋਇਆ ਪਰ ਮੈਨੂੰ ਕੁਛ ਖਾਸ ਇੰਨੀ ਲੱਗੀ ਨਹੀਂ ਗੱਲ ਉਹ ਬੁੱਕ 'ਚ ਜਿਸ ਤੱਕ ਮੇਰਾ ਵਿਊ ਆ ਬਾਕੀ ਦੇਖੋ ਹਰ ਕਿਸੇ ਦਾ ਅਲੱਗ ਅਲੱਗ ਹੁੰਦਾ ਰੁਚੀਆਂ ਦੇ ਹਿਸਾਬ ਨਾਲ ਹੁੰਦਾ ਨਾ ਆਪਣਾ ਆਪਣਾ ਕਿਸੇ ਨੇ ਬਹੁ ਬਹੁਤ ਰੁਝਾਨ ਰੱਖ ਕੇ ਪੜ੍ਹੀ ਹੋਵੇ ਉਹ 'ਚ ਬਹੁਤ ਕੁਛ ਉਹਨੂੰ ਸਿਖਣ ਨੂੰ ਵੀ ਮਿਲਿਆ ਹੋਵੇ ਸ਼ਾਇਦ ਮੇਰਾ ਰੁਝਾਨ ਨਹੀਂ ਸੀਗਾ ਇਸ ਕਰਕੇ ਮੈਨੂੰ ਨਹੀਂ ਇੰਨਾ ਮਿਲਿਆ ਠੀਕ ਸੀਗੀ ਓਕੇ ਆ